ਸਤਿ ਸ਼੍ਰੀ ਅਕਾਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਵਿਅਕਤੀ ਹਾਂ ਵਿਦਿਆਰਥੀ ਲਾ ਲਓ ਤੁਸੀਂ ਅਤੇ ਜਿੱਦਾਂ ਕਿ ਗੱਲ ਕਰਾਂ ਕਿ ਜਿਹੜੀਆਂ ਖੇਡਾਂ ਲੋਕਾਂ ਦੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਕਿਵੇਂ ਯੋਗਦਾਨ ਪਾਉਂਦੀਆਂ ਨੇ ਜਿਹੜੀਆਂ ਖੇਡਾਂ ਹੈਗੀਆਂ ਇਹ ਕਦੇ ਜੇ ਖੇਡਾਂ ਬੰਦਾ ਖੇਡਦਾ ਰਹੇ ਜਾਂ ਰਨਿੰਗ ਕਰਦਾ ਰਹੇ ਜਾਂ ਹੋਰ ਵੀ ਕੋਈ ਹੋਰ ਖੇਡਾਂ ਖੇਡਦਾ ਰਹੇ ਅਤੇ ਜਿਵੇਂ ਕਿ ਡਾਕਟਰ ਦੱਸਦੇ ਹਨ ਕਿ ਖੇਡਾਂ ਖੇਡਣ ਨਾਲ਼ ਕਿ ਬਿਮਾਰੀਆਂ ਨਹੀਂ ਹੁੰਦੀਆਂ ਬਲੱਡ ਪ੍ਰੈਸ਼ਰ ਸਾਡਾ ਠੀਕ ਰਹਿੰਦਾ ਮੋਟਾਪਾ ਨਹੀਂ ਹੁੰਦਾ ਹੋਰ ਵੀ ਜਿਹੜੀਆਂ ਅੰਦਰੂਨੀ ਜਿਹੜੀ ਹੈ ਬਿਮਾਰੀਆਂ ਉਹ ਨਹੀਂ ਹੁੰਦੀਆਂ ਇਸ ਕਰਕੇ ਕਈ ਬਜ਼ੁਰਗ ਡਾਕਟਰ ਜਾਂ ਹੋਰ ਬੰਦੇ ਵੀ ਕਹਿੰਦੇ ਹੈਗੇ ਕਿ ਸਾਨੂੰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਉਹਦੇ ਨਾਲ਼ ਸਿਹਤ ਸਾਡੀ ਠੀਕ ਰਹਿੰਦੀ ਆ ਸੈਰ ਵੀ ਕਰੋ ਜਿਹਦੇ ਨਾਲ਼ ਕਿ ਸਾਡੀ ਮਾਨਸਿਕ ਸਾਨੂੰ ਕਈ ਬੰਦੇ ਕਿ ਸਵੇਰੇ ਜਿਵੇਂ ਸੈਰ ਵੀ ਕਰਦੇ ਹੈਗੇ ਆ ਸੈਰ ਕਰਕੇ ਫਰੈੱਸ਼ ਏਅਰ ਲੈਂਦੇ ਆ ਹਨ ਹੋਰ ਕਈ ਵਾਤਾਵਰਨ ਦੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੈਗੇ ਆ ਅਤੇ ਉਹਦੇ ਨਾਲ਼ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਜਿਹੜੀ ਤੰਦਰੁਸਤੀ ਉਹਦੇ ਨਾਲ਼ ਨਾ ਵੱਧਦੀ ਹੈਗੀ ਆ ਅਤੇ ਬੰਦਾ ਜਿਹੜੇ ਬੁਰੇ ਖਿਆਲਾਂ ਤੋਂ ਵੀ ਬੰਦਾ ਦੂਰ ਰਹਿੰਦਾ ਹੈਗਾ ਅਤੇ ਜਿਹੜੀਆਂ ਹੋਰ ਵੀ ਕਈ ਬੁਰੀਆਂ ਚੀਜ਼ਾਂ ਹੈਗੀਆਂ ਇਹ ਵੀ ਬੰਦਾ ਬੰਦਾ ਇਹਦੇ ਇਹਦੇ ਨਾਲ਼ੋਂ ਦੂਰ ਰਹਿੰਦਾ ਹੈਗਾ ਅਤੇ ਜੇ ਬੰਦਾ ਸੈਰ ਕਰਦਾ ਰਹੇ ਔਰ ਹੈਲਥੀ ਖਾਣਾ ਖਾਏ ਤਾਂ ਉਹਦੇ ਨਾਲ਼ ਉਹ ਹੋਰ ਬੰਦਾ ਸਟਰੋਂਗ ਹੁੰਦਾ ਹੈਗਾ ਅਤੇ ਜੇ ਅਸੀਂ ਕਹੀਏ ਕਿ ਕਿ ਅਸੀਂ ਨਾ ਉਹ ਖੇਡਾਂ ਖੇਡੀਏ ਅਤੇ ਨਾ ਹੀ ਕੋਈ ਵੀ ਹੈਲਥੀ ਫੂਡ ਖਾਈਏ ਤਾਂ ਅਸੀਂ ਜਲਦੀ ਹੀ ਬਿਮਾਰੀਆਂ ਦੇ ਜਿਹੜੇ ਘੇਰੇ ਵਿੱਚ ਅਸੀਂ ਆ ਜਾਵਾਂਗੇ ਇਹਦੇ ਜਿਸ ਕਰਕੇ ਸਾਨੂੰ ਬਿਮਾਰੀਆਂ ਦਾ ਅਤੇ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਅਤੇ ਇਸ ਕਰਕੇ ਸਾਨੂੰ ਹੈਲਦੀ ਖਾਣਾ ਖਾਣਾ ਚਾਹੀਦਾ ਅਤੇ ਜਿੱਦਾਂ ਆਮ ਹੈ ਕਿ ਹੈਲਥ ਦੀ ਜਾਂ ਦੌੜ ਲਾਉਣ ਦੀ ਗੱਲ ਕਰਾਂ ਇਹ ਮੈਂ ਤੁਹਾਨੂੰ ਆਪਣੀ ਆਪਣਾ ਹੀ ਆਪਣੇ ਹੀ ਬਾਰੇ ਦੱਸਣਾ ਕਿ ਜਿਹੜਾ ਮੈਂ ਮੈਨੂੰ ਖੇਡਾਂ ਖੇਡਣਾ ਬੜਾ ਹੀ ਪਸੰਦ ਆ ਅਤੇ ਮੈਨੂੰ ਸ ਇਹਦੇ ਨਾਲ਼ੋਂ ਜ਼ਿਆਦਾ ਮੈਨੂੰ ਕ੍ਰਿਕਟ ਬਹੁਤ ਪਸੰਦ ਹੈਗਾ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਿਹੜਾ ਕਾਲਜ ਦਾ ਮੈਚ ਹੈਗਾ ਲਖਨਊ ਅਤੇ ਹੈਦਰਾਬਾਦ ਦਾ ਉਹ ਮੈਂ ਸਾਰਾ ਹੀ ਮੈਚ ਦੇਖਿਆ ਹੈਗਾ ਅਤੇ ਕ੍ਰਿਕਟ ਖੇਡਣਾ ਅਤੇ ਮੈਨੂੰ ਦੇਖਣਾ ਬਹੁਤ ਪਸੰਦ ਹੈਗਾ ਅਤੇ ਮੇਰੀ ਸਭ ਤੋਂ ਜਿਹੜੀ ਫੇਵਰੇਟ ਟੀਮ ਹੈਗੀ ਹੈ ਉਹ ਚੇਨੱਈ ਹੈਗੀ ਆ ਅਤੇ ਤੁਸੀਂ ਜਾਣਦੇ ਹੀ ਹੋ ਕਿ ਮੈਂ ਜਿਹੜੀ ਮੈਨੂੰ ਦੌੜ ਲਾਉਣਾ ਇੰਨਾਂ ਪਸੰਦ ਹੈਗਾ ਕਿ ਮੈਂ ਦੋ ਜਾਂ ਤਿੰਨ ਵਾਰੀ ਮੈਰਾਥਨ ਮੈਰਾਥਨ ਰੇਸਾਂ ਵੀ ਦੌੜੀਆਂ ਹੈਗੀਆਂ ਅਤੇ ਦੋ ਤਿੰਨ ਮੈਰਾਥਨ ਰੇਸਾਂ ਦੌੜੀਆਂ ਹੈਗੀਆਂ ਅਤੇ ਮੈਂ ਉਹਦੇ ਵਿੱਚ ਮੇਰਾ ਦੂਜਾ ਸਥਾਨ ਆਇਆ ਵਾ ਹੈਗਾ ਅਤੇ ਦੂਜਾ ਸਥਾਨ ਤਾਂ ਇਹ ਜਿਹੜਾ ਵਾ ਆਪਣੇ ਜਿਹੜੇ ਮੈਨੂੰ ਦੌੜਨ ਦਾ ਸ਼ੌਂਕ ਸੀ ਇਹ ਵੈਸੇ ਹੀ ਨੈਚੁਰਲੀ ਮੈਂ ਮੁੰਡਿਆਂ ਵੱਲ ਦੇਖਦਾ ਸੀਗਾ ਅਤੇ ਉਹ ਸਾਰੇ ਦੌੜ ਲਾਉਂਦੇ ਸੀ ਅਤੇ ਸਾਰੇ ਬੋਲਦੇ ਸੀਗੇ ਕਿ ਮੈਂ ਆਰਮੀ ਵਿੱਚ ਜਾਣਾ ਜਾਂ ਇੱਦਾਂ ਅਤੇ ਉਹਦੇ ਨਾਲ਼ ਮੈਂ ਵੀ ਦੌੜ ਲਾਉਣੀ ਸ਼ੁਰੂ ਕਰਤੀ ਜਿਹਦਾ ਵੀ ਮੇਰਾ ਨਾ ਉਤਸਾਹ ਜਿਹੜਾ ਉਹ ਵੱਧ ਗਿਆ ਮੇਰਾ ਵੀ ਥੋੜ੍ਹਾ ਜਿਹਾ ਦਿਲ ਕਰਨ ਲੱਗ ਲੱਗ ਪਿਆ ਜੀ ਮੈਂ ਵੀ ਦੌੜ ਲਾਵਾਂ ਜਾਂ ਮੈਂ ਵੀ ਆਪਣੇ ਫਿਊਚਰ ਵਿੱਚ ਇੱਦਾਂ ਕੁਝ ਕਰਨਾ ਹੈਗਾ ਕੁਝ ਹਾਸਿਲ ਕਰਨਾ ਹੈਗਾ ਅਤੇ ਮੈਂ ਦੌੜ ਲਾਉਣੀ ਸ਼ੁਰੂ ਕਰਤੀ ਮੈਂ ਰੋਜ਼ ਮੁੰਡਿਆਂ ਨਾਲ਼ ਛੇ ਵਜੇ ਦੌੜ ਲਾਉਣ ਜਾਂਦਾ ਸੀਗਾ ਦੌੜ ਲਾ ਕੇ ਪਹਿਲੇ ਉਸ ਤੋਂ ਬਾਅਦ ਵਾਰਮ ਅੱਪ ਕਰਨਾ ਜਿਹੜਾ ਅੱਧਾ ਘੰਟਾ ਫਿਰ ਉਸ ਤੋਂ ਬਾਅਦ ਦੌੜ ਲਾਉਣੀ ਦੌੜ ਲਾ ਕੇ ਫਿਰ ਅਸੀਂ ਆਉਂਦੇ ਵੇਲੇ ਉਹ ਕਰਨਾ ਐਕਸਰਸਾਈਜ਼ ਕਰਨੀ ਫਿਰ ਅਸੀਂ ਆਪਣੇ ਆਪਣੇ ਘਰ ਚਲੇ ਜਾਂਦੇ ਸੀ ਫਿਰ ਘਰ ਜਿਹੜਾ ਸਾਰਾ ਕੰਮ ਕਰਨਾ ਹੈਗਾ ਅਤੇ ਹੈਲਦੀ ਫੂਡ ਖਾਣਾ ਸੀਗਾ ਖਾਂਦ ਖਾਂਦੇ ਸੀਗੇ ਅਤੇ ਜਿਹੜਾ ਵੀ ਹੈਲਦੀ ਫੂਡ ਖਾਣਾ ਅਤੇ ਪਰ ਜਿਹੜਾ ਫਾਸਟ ਫੂਡ ਨਹੀਂ ਖਾਣਾ ਕਿਉਂਕਿ ਉਹ ਫਾਸਟ ਫੂਡ ਖਾਣ ਨਾਲ਼ ਜਿਹੜਾ ਸਾਡਾ ਸਰੀਰ ਹੈਗਾ ਅਤੇ ਜਿਹੜੀ ਮਾਨਸਿਕ ਅਤੇ ਜਿਹੜੀ ਸਰੀਰਕ ਆ ਉਹ ਥੋੜ੍ਹੀ ਕਮਜ਼ੋਰ ਹੋ ਜਾਂਦੇ ਆ ਅਤੇ ਬੰਦਾ ਬਿਮਾਰੀਆਂ ਦੇ ਘੇਰੇ ਵਿੱਚ ਆ ਜਾਂਦਾ ਅਤੇ ਅਸੀਂ ਜਿਹੜਾ ਘਰ ਘੁਰ ਦਾ ਕੰਮ ਕਰਦੇ ਸੀਗੇ ਅਤੇ ਘਰ ਦੇ ਕੰਮ ਕਰਨ ਤੋਂ ਬਾਅਦ ਤਾਂ ਅਸੀਂ ਸ਼ਾਮ ਨੂੰ ਫਿਰ ਦੋ ਗਰਾ ਪਾਰਕ ਵਿੱਚ ਜਾਂਦੇ ਸੀਗੇ ਪਾਰਕ ਵਿੱਚ ਅਸੀਂ ਕਈ ਖੇਡਾਂ ਖੇਡਦੇ ਸੀਗੇ ਖੇਡਾਂ ਖੇਡ ਕੇ ਆਪਣਾ ਮਨੋਰੰਜਨ ਕਰਦੇ ਸੀਗੇ ਅਤੇ ਉੱਥੇ ਸੈਰ ਸਪਾਟਾ ਕਰਦੇ ਸੀਗੇ ਸ ਜਿਹਦੇ ਨਾਲ਼ ਸਾਡਾ ਜਿਹੜਾ ਮਨ ਹਿਰਦੇ ਜਿਹੜਾ ਉਹ ਸੰਤੁਸ਼ਟ ਰਹਿੰਦਾ ਸੀ ਅਤੇ ਸਾਨੂੰ ਬੜਾ ਹੀ ਚੰਗਾ ਅਤੇ ਚੰਗਾ ਮਹਿਸੂਸ ਹੁੰਦਾ ਸੀਗਾ ਅਤੇ ਇਸ ਕਰਕੇ ਮੈਂ ਆਪਣੇ ਉਹ ਜਿੱਦਾਂ ਕਿ ਮੈਂ ਆਪਣੀ ਜ਼ਿੰਦਗੀ 'ਚ ਇੰਨਾਂ ਕੁਝ ਕੀਤਾ ਹੈਗਾ ਕਿ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਨੂੰ ਜਿਹੜਾ ਕਿ ਸੈਰ ਸਪਾਟਾ ਕਰਦੇ ਰਹਿਣਾ ਚਾਹੀਦਾ ਅਤੇ ਦੌੜ ਵੀ ਲਾਉਣੀ ਚਾਹੀਦੀ ਆ ਅਤੇ ਕਦੇ ਵੀ ਸਾਨੂੰ ਕਦੇ ਵੀ ਮਤਲਬ ਕਿ ਰੋਜ਼ ਸਾਨੂੰ ਉਹ ਨਹੀਂ ਖਾਣਾ ਚਾਹੀਦਾ ਉਹ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਜਿਹਦੇ ਕਰਕੇ ਸਾਡੇ ਸਰੀਰ ਨੂੰ ਥੋੜ੍ਹੀ ਹਾਨੀ ਹੋਏ ਅਤੇ ਅਸੀਂ ਬਿਮਾ ਬਿਮਾਰੀਆਂ ਦੇ ਘੇਰੇ ਵਿੱਚ ਆ ਜਾਈਏ ਅਤੇ ਮੈਂ ਤੁਹਾਨੂੰ ਇਹੀ ਦੱਸਣਾ ਕਿ ਦੌੜ ਲਾਓ ਧੰਨਵਾਦ